ਹੈਲੋ ਸਤਿ ਸ਼੍ਰੀ ਅਕਾਲ ਜੀ ਮੈਂ ਤੁਸੀਂ ਹਰਮਨ ਕੈਟਰਿੰਗ ਤੋਂ ਬੋਲਦੇ ਮੈਨੂੰ ਮੇਰੀ ਫਰੈਂਡ ਨੇ ਤੁਹਾਡਾ ਨੰਬਰ ਦਿੱਤਾ ਸੀ ਮੈਂ ਸਾਡੇ ਨਾ ਇੱਕ ਤਰੀਕ ਨੂੰ ਵਿਆਹ ਸੀਗਾ ਮੈਂ ਥੋੜ੍ਹੇ ਜਿਹੇ ਫੂਡ ਔਡਰ ਕਰਨੇ ਸੀਗੇ ਅਤੇ ਮਟਰ ਪਨੀਰ ਹੋ ਗਿਆ ਇਹ ਸਾਗ ਹੋ ਗਿਆ ਜਿਦਾਂ ਕੋਪਤੇ ਹੋ ਗਿਆ ਹਾਂਜੀ ਮੈਨੂੰ ਹੁਣ ਨਾ ਚਾਹੀਦੀ ਸੀਗੀ ਅਤੇ ਪਰ ਪਲੇਟ ਕਿੰਨੇ ਕੁ ਕੋਸਟ ਦੀ ਹੈ ਅੱਛਾ ਜੀ ਵਧੀਆ ਕੁਆਲਟੀ ਦੀ ਹੋਣੀ ਚਾਹੀਦੀ ਹੈ ਜੀ ਹਾਂਜੀ ਹਾਂਜੀ ਪਿਛਲੀ ਵਾਰ ਨਾ ਮੇਰਾ ਬਰਡੇ ਸੀਗਾ ਮੈਂ ਪਾਰਟੀ ਕੀਤੀ ਸੀ ਘਰੇ ਉਹ ਨਾ ਸਮਾਨ ਵਧੀਆ ਨਿਕਲਿਆ ਸੀ ਇਹ ਨਾ ਦੂਸਰੀ ਕੈਟਰਿੰਗ ਤੋਂ ਲਈ ਸੀਗੀ ਹਾਂਜੀ ਉਹ ਵਧੀਆ ਨਿਕਲਿਆ ਸੀ ਫਿਰ ਤਾਂ ਕਰਕੇ ਮੈਨੂੰ ਮੇਰੀ ਫਰੈਂਡ ਨੇ ਨੰਬਰ ਦਿੱਤਾ ਤੁਹਾਡਾ ਤਾਂ ਕਰਕੇ ਉਹਦਾ ਸਿਰੇ ਸੀ ਤੁਹਾਡੇ ਸਮਾਨ ਵਧੀਆ ਹੁੰਦਾ ਏ ਹਾਂਜੀ ਸਰ ਮੈਨੂੰ ਹੈ ਨਾ ਤੁਸੀਂ ਦੇ ਜੋ ਮਿੱਠੇ ਵਿਚ ਮੈਨੂੰ ਅਤੇ ਇੱਕ ਹਲਵਾ ਦੇ ਦਿਓ ਇੱਕ ਕੜਾਹ ਦੇ ਦਿਓ ਅਤੇ ਗਰਮ ਰਸਗੁੱਲੇ ਹਾਂਜੀ ਹਾਂਜੀ ਮੇਰੇ ਕੋਲ ਤੁਹਾਡਾ ਨੰਬਰ ਆਗਿਆ ਮੈਂ ਜੋ ਵੀ ਚਾਹੀਦਾ ਹੋਵੇਗਾ ਮੈਨੂੰ ਮੈਂ ਤੁਹਾਨੂੰ ਦੱਸਦਗੀ ਮੈਸੇਜ ਕਰਦੂੰਗੀ ਹਾਂਜੀ ਠੀਕ ਹੈ ਪਰ ਵਧੀਆ ਕੁਆਲਿਟੀ ਹੋਣੀ ਚਾਹੀਦੀ ਹਾਂਜੀ ਓਕੇ ਠੀਕ ਹੈ ਥੈਂਕ ਯੂ